ਮੈਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਐਮਾਜ਼ੋਨ ਤੋਂ ਇੱਕ ਹੋਮ ਥਿਏਟਰ ਔਰਡਰ ਕੀਤੇ ਸਨ ਜਿਸਦਾ ਕਿ ਐਕਸਪੀਰੀਅੰਸ ਮੇਰੇ ਨਾਲ਼ ਬਹੁਤ ਜ਼ਿਆਦਾ ਮਾੜਾ ਰਿਹਾ ਪਹਿਲਾ ਐਕਸਪੀਰੀਅੰਸ ਦਾ ਮਾੜਾ ਹੋਣ ਦਾ ਰੀਜ਼ਨ ਇਹ ਸੀ ਕਿ ਉਹਨਾਂ ਨੇ ਡਿਲੀਵਰੀ ਲਈ ਮੇਰੇ ਤੋਂ ਪੱਚੀ ਤੋਂ ਤੀਹ ਦਿਨ ਲਏ ਜੋ ਕਿ ਬਹੁਤ ਹੀ ਗਲਤ ਗੱਲ ਸੀ ਮੈਂ ਲੋਹੜੀ ਦਾ ਫੰਕਸ਼ਨ ਨੂੰ ਹੋਰ ਮਨੋਰੰਜਨ ਬਣਾਉਣ ਦੇ ਲਈ ਸਪੀਕਰ ਔਰਡਰ ਕੀਤੇ ਸੀ ਤਾਂ ਜੋ ਮੈਂ ਲੋਹੜੀ ਵਾਲੇ ਦਿਨ ਸਪੀਕਰ ਲਗਾ ਕੇ ਮਨੋਰੰਜਨ ਕਰ ਸਕਾਂ ਪਰ ਉਸ ਦਿਨ ਮੈਨੂੰ ਬਹੁਤ ਜ਼ਿਆਦਾ ਡੀਸੈਟਿਸਫੈਕਸ਼ਨ ਹੋਈ ਕਿਉਂਕਿ ਮੇਰਾ ਪ੍ਰੋਡਕਟ ਮੇਰੇ ਤੋਂ ਰਿਸੀਵ ਨਹੀਂ ਹੋ ਸਕਿਆ ਉਸ ਤੋਂ ਬਾਅਦ ਜਦੋਂ ਮੈਂ ਔਰਡਰ ਰਸੀਵ ਕੀਤਾ ਅਤੇ ਬੋਕਸ ਨੂੰ ਖੋਲ੍ਹਿਆ ਤਾਂ ਸਪੀਕਰ ਦੀਆਂ ਵਾਈਰਸ ਵਿੱਚੋਂ ਕੱਟੀਆਂ ਨਿਕਲੀਆਂ ਮਤਲਬ ਕਿ ਟੁੱਟੀਆਂ ਹੋਈਆਂ ਸਨ ਉਹ ਐਕਸਪੀਰੀਅੰਸ ਮੇਰਾ ਇੰਨਾ ਜ਼ਿਆਦਾ ਮਾੜਾ ਸੀ ਕਿ ਮੈਂ ਉਸ ਦਿਨ ਠਾਣ ਲਿਆ ਸੀ ਕਿ ਮੈਂ ਅੱਜ ਤੋਂ ਬਾਅਦ ਐਮਾਜ਼ੋਨ ਤੋਂ ਕੋਈ ਵੀ ਚੀਜ਼ ਨਹੀਂ ਔਰਡਰ ਕਰੂੰਗਾ ਉਹ ਵੀ ਇੱਕ ਗਲਤ ਗੱਲ ਹੈ ਕਿਉਂਕਿ ਅੱਗੇ ਵੀ ਮੈਂ ਐਮਾਜ਼ੋਨ ਤੋਂ ਕਈ ਚੀਜ਼ਾਂ ਮੰਗਵਾਈਆਂ ਹਨ ਅਤੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹਰ ਵਾਰੀ ਪਰ ਇਸ ਵਾਰ ਮੈਂ ਬਹੁਤ ਜ਼ਿਆਦਾ ਡਿਸਸੈਟਿਸਫਾਈਡ ਫੀਲ ਕਰਦਾ ਸੀ ਉਹਦੀਆਂ ਵਾਈਰਸ ਬਿਲਕੁਲ ਹੀ ਟੁੱਟੀਆਂ ਸਨ ਉਹਦੇ ਉੱਪਰ ਉਹਨੂੰ ਠੀਕ ਕਰਵਾਉਣ ਲਈ ਮੇਰਾ ਦੋ ਹਜ਼ਾਰ ਰੁਪਏ ਖਰਚਾ ਹੋਰ ਲੱਗਿਆ ਟੋਟਲ ਕੀਮਤ ਛੇ ਹਜ਼ਾਰ ਰੁਪਏ ਦੀ ਸੀ ਅਤੇ ਮੈਨੂੰ ਅੱਠ ਹਜ਼ਾਰ ਰੁਪਏ ਕੀਮਤ ਦੇ ਵਿੱਚ ਉਹ ਹੋਮ ਥਿਏਟਰ ਪਿਆ ਉਹ ਵੀ ਪੱਚੀ ਤੀਹ ਦਿਨ ਦੀ ਡਿਲੀਵਰੀ ਤੋਂ ਬਾਅਦ